ਪੰਜਾਬੀ ਭਾਸ਼ਾ ਦਾ ਆਪਣਾ ਵੱਖਰਾ ਵਜੂਦ ਹੈ ਪੰਜਾਬ ਦੇ ਇਲਾਕੇ ਦੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਪੰਜਾਬੀ ਕਿਹਾ ਜਾਂਦਾ ਹੈ ਪਰ ਅੱਜ ਕੱਲ੍ਹ ਹਰ ਇਲਾਕੇ ਦੇਸ਼ ਵਿਦੇਸ਼ ਹਰ ਪਾਸੇ ਜਿਹੜਾ ਹੈ ਉਹ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਦੀ ਆਪਣੀ ਹੀ ਵਿਲੱਖਣਤਾ ਹੈ ਅਤੇ ਇਹ ਹੈ ਕਿ ਇਹ ਸਹਿ ਸੁਭਾਅ ਹੀ ਹਰ ਕੋਈ ਬੋਲਣ ਲੱਗ ਪੈਂਦਾ ਹੈ ਅੱਜ ਕੱਲ੍ਹ ਹਰ ਪਾਸੇ ਕੋਂਪੀਟੀਸ਼ਨ ਹੋ ਰਿਹਾ ਹੈ ਸਕੂਲਾਂ ਵਿੱਚ ਵੀ ਜਿਹੜਾ ਹੈ ਇੰਗਲਿਸ਼ ਮੀਡੀਅਮ ਹੋਣ ਕਰਕੇ ਜਿਹੜਾ ਹੈ ਅੰਗਰੇਜ਼ੀ ਬੋਲਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਮਤਲਬ ਹਰ ਬੱਚਿਆਂ ਨੂੰ ਜਿਹੜਾ ਕਿਹਾ ਜਾਂਦਾ ਕਿ ਤੁਸੀਂ ਬਸ ਅੰਗਰੇਜ਼ੀ ਹੀ ਬੋਲਣੀ ਹੈ ਕੋਂਪੀਟੀਸ਼ਨ ਐਗਜ਼ਾਮ ਜਿਹੜੇ ਹੋ ਰਹੇ ਨੇ ਆਈ ਏ ਐੱਸ ਆਈ ਪੀ ਐੱਸ ਹੋਰ ਬਹੁਤ ਸਾਰੇ ਜਿਹੜੇ ਨੇ ਉਹ ਵੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਹੋ ਰਹੇ ਹਨ ਜਿਸ ਕਰਕੇ ਅੰਗਰੇਜ਼ੀ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਦਫਤਰਾਂ ਦੇ ਵਿੱਚ ਜਿਹੜੀ ਭਾਸ਼ਾ ਹੈ ਉਹ ਵੀ ਅੰਗਰੇਜ਼ੀ ਵਿੱਚ ਹੀ ਹੈ ਕਿਉਂਕਿ ਸਾਰੇ ਕੰਮ ਜਿਹੜੇ ਉਹ ਅੰਗਰੇਜ਼ੀ ਦੇ ਵਿੱਚ ਹੀ ਹੋ ਰਹੇ ਹਨ ਜਿਹੜੇ ਜ ਮਤਲਬ ਉਹ ਚਾਹੇ ਚਿੱਠੀ ਪੱਤਰ ਜਿਹੜੇ ਨੇ ਉਹ ਵੀ ਅੰਗਰੇਜ਼ੀ ਦੇ ਵਿੱਚ ਹੀ ਹੋ ਰਹੇ ਹੈ ਭਾਸ਼ਣ ਜਿਹੜੇ ਹੈ ਉਹ ਵੀ ਅੰਗਰੇਜ਼ੀ ਦੇ ਵਿੱਚ ਹੀ ਹੁੰਦੇ ਹਨ ਅੱਜ ਕੱਲ੍ਹ ਜਿਹੜਾ ਹੈ ਨੌਜਵਾਨ ਪੀੜ੍ਹੀ ਦੇ ਵਿੱਚ ਜਿਹੜਾ ਹੈ ਵਿਦੇਸ਼ਾਂ ਦੇ ਵਿੱਚ ਜਾਣ ਦੀ ਹੂਲ ਲੱਗੀ ਹੋਈ ਹੈ ਜਿਹੜੀ ਉਹ ਉੱਥੇ ਜਾ ਕੇ ਜਿਹੜਾ ਹੈ ਵਸਣਾ ਚਾਹੁੰਦੀ ਹੈ ਅਤੇ ਉਹ ਜਿਹੜੇ ਹੈ ਉੱਥੇ ਜਿਸ ਕਰਕੇ ਉਹ ਜਿਹੜਾ ਅੰਗਰੇਜ਼ੀ ਭਾਸ਼ਾ ਨੂੰ ਪਹਿਲ ਦੇ ਰਹੇ ਹਨ ਵਿਦੇਸ਼ਾਂ ਦੇ ਵਿੱਚ ਜਾ ਕੇ ਉੱਥੇ ਜਿਹੜਾ ਕੰਮ ਕਰਨਾ ਚਾਹੁੰਦੇ ਹਨ ਅਤੇ ਸਾਡਾ ਜਿਹੜੇ ਸਾਡੇ ਇੱਥੋਂ ਜਿਹੜੇ ਪੰਜਾਬੀ ਗਏ ਹਨ ਉੱਥੇ ਜਾ ਕੇ ਪੜ੍ਹਾਈ ਕਰਕੇ ਸਰਕਾਰੀ ਨੌਕਰੀ ਵੀ ਪ੍ਰਾਪਤ ਕਰ ਰਹੇ ਹਨ ਅਤੇ ਉਹ ਜਿਹੜੇ ਹੈ ਉੱਥੇ ਜਿਹੜੇ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਹੈ ਉਹ ਭਾਸ਼ਣ ਦਿੰਦੇ ਹਨ ਪੰਜਾਬੀ ਅਤੇ ਉਹ ਜਿਹੜੀ ਸ ਸਾਡੀ ਜਿਹੜੀ ਹੈ ਉਹ ਪੰਜਾਬੀ ਭਾਸ਼ਾ ਨੂੰ ਉਹ ਅੱਗੇ ਲੈ ਕੇ ਜਾ ਰਹੀ ਹੈ ਅਤੇ ਇਸ ਸਭ ਦੇ ਮਤਲਬ ਜਿਹੜਾ ਹੈਗਾ ਏ ਹੁਣ ਪੰਜਾਬੀ ਭਾਸ਼ਾ ਨੂੰ ਜਿਹੜਾ ਹੈ ਇੱਥੋਂ ਤੱਕ ਕਿ ਉੱਥੇ ਜਿਹੜੇ ਬਹੁਤੇ ਹੀ ਦੇਸ਼ਾਂ ਦੇ ਵਿੱਚ ਜਿਹੜਾ ਹੈ ਉਹ ਦੂਜਾ ਦੂਜੀ ਭਾਸ਼ਾ ਦਾ ਦਰਜਾ ਮਿਲ ਰਿਹਾ ਹੈ ਜੋ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ